ਯੋਗ ਯੋਗ ਕਰਨਾ ਬੜਾ ਜ਼ਰੂਰੀ ਹੈ ਯੋਗਾ ਦੇ ਨਾਲ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਜੇ ਤੁਸੀਂ ਯੋਗ ਕਰੋਗੇ ਤਾਂ ਯੋਗਾ ਯੋਗਾ ਦੇ ਨਾਲ ਸਰੀਰ ਤਾਂ ਤੰਦਰੁਸਤ ਰਹਿੰਦਾ ਹੀ ਹੈ ਤੁਸੀਂ ਮਾਨਸਿਕ ਪੱਖੋਂ ਵੀ ਬਹੁਤ ਜ਼ਿਆਦਾ ਵਧੀਆ ਮਹਿਸੂਸ ਕਰੋਗੇ ਯੋਗ ਕਰਨ ਦੇ ਨਾਲ ਤੁਹਾਡਾ ਸਰੀਰ ਤਾਂ ਤੰਦਰੁਸਤ ਹੋਵੇਗਾ ਹੀ ਨਾਲ ਤੁਹਾਡੇ ਸਰੀਰ ਦੇ ਵਿੱਚ ਬਿਮਾਰੀਆਂ ਵੀ ਦੂਰ ਰਹਿਣਗੀਆਂ ਤੁਸੀਂ ਆਪਣੇ ਘਰ ਦੇ ਕੰਮਾਂ ਨੂੰ ਬਾਹਰ ਦੇ ਕੰਮਾਂ ਨੂੰ ਬੜੀ ਸੋਹਣੀ ਤਰ੍ਹਾਂ ਕਰੋਗੇ ਇਹਨਾਂ ਦੇ ਲਾਭ ਵੀ ਬਹੁਤ ਹਨ ਪਹਿਲਾਂ ਮੈਂ ਪਹਿਲਾਂ ਬਹੁਤ ਮੋਟੀ ਹੁੰਦੀ ਸੀ ਅਤੇ ਮੈਨੂੰ ਕਿਤੇ ਜਾਣਾ ਪਸੰਦ ਵੀ ਨਹੀਂ ਸੀ ਹੁੰਦਾ ਮੈਂ ਕਿਸੇ ਨੂੰ ਮਿਲ ਕੇ ਨਹੀਂ ਸੀ ਚ ਆਪਣੇ ਆਪ ਨੂੰ ਚੰਗਾ ਮਹਿਸੂਸ ਕਰਦੀ ਨਾ ਮੈਂ ਕਿਸੇ ਦੇ ਘਰ ਜਾਂਦੀ ਸੀ ਨਾ ਮੈਂ ਕੋਈ ਆਫਿਸ ਜਾਂਦੀ ਸੀ ਯੋਗ ਕਰਨ ਦੇ ਨਾਲ ਨਾਲ ਮੈਂ ਜਦੋਂ ਯੋਗਾ ਕਰਨਾ ਸ਼ੁਰੂ ਕੀਤਾ ਤਾਂ ਮੈਂ ਇਸ ਨਾਲ ਪਤਲੀ ਵੀ ਹੋ ਗਈ ਮੈਂ ਕਈ ਤਰ੍ਹਾਂ ਦੇ ਯੋਗਾ ਦੇ ਅਭਿਆਸ ਕੀਤੇ ਫਿਰ ਮੈਂ ਪਤਲੀ ਹੋ ਗਈ ਪਤਲੀ ਹੋਣ ਦੇ ਨਾਲ ਮੈਂ ਸੋਹਣੀ ਵੀ ਲੱਗਣ ਲੱਗ ਗਈ ਸੋਹਣੀ ਲੱਗਣ ਦੇ ਨਾਲ ਨਾਲ ਮੈਨੂੰ ਆਪਣੇ ਲੋਕਾਂ ਦੇ ਘਰ ਜਾਣਾ ਬੜਾ ਚੰਗਾ ਲੱਗਣ ਲੱਗਾ ਕਿਉਂਕਿ ਪਹਿਲਾਂ ਤਾਂ ਮੋਟੀ ਹੋਣ ਕਰਕੇ ਲੋਕ ਮੈਨੂੰ ਗੱਲਾਂ ਕਰਦੇ ਸੀ ਪਰ ਹੁਣ ਜਦੋਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਯੋਗ ਕਰਕੇ ਬਦਲਾਵ ਵੇਖਿਆ ਤਾਂ ਮੈਨੂੰ ਬੜੀ ਖੁਸ਼ ਹੋਇਆ ਜਦੋਂ ਲੋਕਾਂ ਨੇ ਮੈਨੂੰ ਕਿਹਾ ਕਿ ਹੁਣ ਤੇਰਾ ਸਰੀਰ ਠੀਕ ਹੋ ਗਿਆ ਤੂੰ ਬਹੁਤ ਵਧੀਆ ਲੱਗਦੀ ਆ ਇਸ ਕਰਕੇ ਮੇਰਾ ਉਹਨਾਂ ਦੇ ਨਾਲ ਰਿਸ਼ਤਾ ਬਹੁਤ ਵਧੀਆ ਹੋ ਗਿਆ ਫਿਰ ਮੈਂ ਆਪਣੇ ਆਫਿਸ ਜਾਣਾ ਮੈਂ ਨੌਕਰੀ ਵੀ ਕਰਨੀ ਸ਼ੁਰੂ ਕਰ ਦਿੱਤੀ ਮੈਂ ਲੋਕਾਂ ਨਾਲ ਮਿਲਣਾ ਜੁਲਣਾ ਵੀ ਸ਼ੁਰੂ ਕਰ ਦਿੱਤਾ ਮੈਂ ਆਪਣੇ ਬੱਚਿਆਂ ਨਾਲ ਆਪਣੀ ਫੈਮਿਲੀ ਨਾਲ ਵੀ ਸੋਹਣੀ ਤਰ੍ਹਾਂ ਬੋਲਣ ਲੱਗ ਪਈ ਸੀ ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਚਿੜਚਿੜਾ ਮਹਿਸੂਸ ਕਰਦੀ ਸੀ ਮੈਂ ਕਿਸੇ ਨਾਲ ਬੋਲਣਾ ਪਸੰਦ ਨਹੀਂ ਸੀ ਕਰਦੀ ਕਿਉਂਕਿ ਲੋਕ ਮੈਨੂੰ ਉਦੋਂ ਤਾਨੇ ਮੇਣੇ ਦਿੰਦੇ ਸੀ ਕਿ ਤੂੰ ਸੋਹਣੀ ਨਹੀਂ ਲੱਗਦੀ ਅਤੇ ਉਸ ਪਰ ਯੋਗ ਨੇ ਮੇਰੇ ਸਰੀਰ ਦੇ ਅੰਦਰ ਬਹੁਤ ਜ਼ਿਆਦਾ ਬਦਲਾਵ ਲਿਆਉਂਦਾ ਮੈਂ ਆਪਣੇ ਆਪ ਨੂੰ ਤਰੋ ਤਾਜ਼ਾ ਅਤੇ ਬਹੁਤ ਵਧੀਆ ਮਹਿਸੂਸ ਕਰਨ ਲੱਗ ਪਈ ਮੈਂ ਯੋਗ ਕਰਨ ਦੇ ਨਾਲ ਰੋਜ਼ ਰੋਜ਼ਾਨਾ ਯੋਗਾ ਦੇ ਨਾਲ ਮੇਰੇ ਸਰੀਰਕ ਸ਼ਕਤੀ ਵੀ ਬਹੁਤ ਜ਼ਿਆਦਾ ਆ ਗਈ ਮੇਰਾ ਸਰੀਰ ਵੀ ਮੇਰੀ ਉਮਰ ਘੱਟ ਲੱਗਣ ਲੱਗ ਪਈ ਮੈਂ ਸੋਹਣੀ ਲੱਗਣ ਲੱਗ ਪਈ ਮੈਂ ਸਾਰੇ ਕੰਮ ਵੀ ਭੱਜ ਭੱਜ ਕੇ ਕਰਨ ਲੱਗ ਗਈ ਅਤੇ ਇਹਨਾਂ ਇਹਨਾਂ ਯੋਗ ਦੇ ਨਾਲ ਮੇਰੇ ਸਰੀਰ ਅਤੇ ਮੇਰੇ ਜ਼ਿੰਦਗੀ 'ਤੇ ਇੰਨਾ ਪ੍ਰਭਾਵ ਪਿਆ ਕਿ ਮੈਂ ਸਾਰੇ ਆਪਣੇ ਰਿਸ਼ਤਾਦਾਰ ਘਰ ਮੈਂ ਆਪਣੀ ਨੌਕਰੀ ਵੱਲ ਮੈਂ ਹਰ ਚੀਜ਼ ਵੱਲ ਬਹੁਤ ਜ਼ਿਆਦਾ ਧਿਆਨ ਕਰਨ ਲੱਗ ਪਈ ਇਸ ਤਰ੍ਹਾਂ ਕਰਨ ਨਾਲ ਯੋਗ ਦਾ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ